ਮੈਂ ਚਿੱਤਰ ਬਣਾਉਂਦਾ ਹਾਂ ਸਹੀ ਅਨੁਪਾਤ ਅਤੇ ਦੇ ਗਿਆਨ ਨੂੰ ਯਕੀਨੀ ਬਣਾਉਣ ਲਈ ਕੁਝ ਖ਼ਾਸ ਤਰੀਕਿਆਂ ਦੀ ਪਾਲਣਾ ਕਰਦਾ ਹਾਂ ਪਹਿਲਾਂ ਮੈਂ ਬੇਸ ਬੇਸਿਕ ਤੋਂ ਸ਼ੁਰੂ ਕਰਦਾ ਜਿਵੇਂ ਸਧਾਰਨ ਆਕਾਰ ਜਿਵੇਂ ਸਰਕਲ ਓਵਲ ਲਾਈਨ ਦੇ ਨਾਲ ਸ਼ਕਲਾਂ ਬਣਾਉਂਦਾ ਹਾਂ ਜਿਸ ਨਾਲ ਮੂਲ ਰੂਪ 'ਤੇ ਤਿਆਰ ਹੁੰਦਾ ਹੈ ਵਰ ਗਾਈਡਲਾਈਨ ਵਰਤਣੀ ਬਹੁਤ ਜ਼ਰੂਰੀ ਨਹੀਂ ਹੈ ਜਿਵੇਂ ਕਿ ਮੈਂ ਸਭ ਲਈ ਇੱਕ ਕੇਂਦਰੀ ਲਾਈਨ ਬਣਾਉਂਦਾ ਹਾਂ ਜੇ ਜੋ ਚਿਹਰੇ ਦੀ ਸਮਰੁਤਾ ਬਣੀ ਰਹੇ ਸਰੀਰ ਦੇ ਹਿੱਸਿਆਂ ਨੂੰ ਸਹੀ ਅਨੁਪਾਤ ਰੱਖਣ ਲਈ ਮੈਂ ਹ ਵਰਤਣਾ ਹਾਂ ਜਿਵੇਂ ਚੀਜ਼ ਉਚਾਈ ਲਈ ਆਮ ਵਿਅਕਤੀ ਉਚਾਈ ਤਕਰੀਬਨ ਸੱਤ ਤੋਂ ਅੱਠ ਸੀਟ ਦੇ ਬਰਾਬਰ ਹੁੰਦੀ ਹੈ ਸਰੀਰ ਨੂੰ ਚਾਲ ਨੂੰ ਉਚਿਤ ਬਣਾਇਆ ਜਾ ਰਿਹਾ ਹੈ ਜੇਕਰ ਮੈਂ ਡਿਜੀਟਲ ਮੀਡੀਆ ਵਿੱਚ ਕੰਮ ਕਰ ਰਿਹਾ ਤਾਂ ਮੈਂ ਗਰਿਡ ਟੂਲ ਜਾਂ ਲੋਕ ਟੂਲ ਵ ਰਤ ਕੇ ਅਨੁਪਾਤ ਦੀ ਜਾਂਚ ਕਰ ਲੈਂਦਾ ਹਾਂ ਮੈਂ ਚਿੱਤਰ ਨੂੰ ਵਾਰ ਵਾਰ ਵੇਖ ਕੇ